ਹੈਲੋ ਸਤਿ ਸ਼੍ਰੀ ਅਕਾਲ ਸਰ ਤੁਸੀਂ ਅਨੇਜਾ ਸਵੀਟਸ ਤੋਂ ਬੋਲ ਰਹੇ ਹੋ ਸਰ ਕੱਲ੍ਹ ਸ਼ਾਮ ਨੂੰ ਤੁਹਾਡੀ ਸਵੀਟਸ 'ਤੇ ਇੱਕ ਕੇਕ ਔਡਰ ਕੀਤਾ ਗਿਆ ਸੀ ਜੋ ਅੱਜ ਸਵੇਰੇ ਦਸ ਵਜੇ ਤੱਕ ਦੀ ਡਿਲੀਵਰੀ ਸੀ ਜਿਸਦੀ ਪਰ ਤੁਹਾਡੇ ਵੱਲੋਂ ਉਹ ਡਿਲੀਵਰੀ ਬਹੁਤ ਲੇਟ ਕੀਤੀ ਗਈ ਹੈ ਲਗਭਗ ਦੋ ਘੰਟੇ ਬਹੁਤ ਸਮਾਂ ਸਾਨੂੰ ਉਡੀਕ ਕਰਨੀ ਪਈ ਅਸੀਂ ਇਹ ਸੋਚ ਰਹੇ ਸੀ ਵੀ ਕਿਤੋਂ ਹੋਰ ਜਿਹੜਾ ਕੇਕ ਦੁਬਾਰਾ ਔਡਰ ਕਰ ਲਿਆ ਜਾਵੇ ਪਰ ਤੁਸੀਂ ਬਹੁਤ ਲੇਟ ਕਰ ਦਿੱਤਾ ਚਲੋ ਪਹੁੰਚ ਗਿਆ ਪਰ ਇਹ ਤੁਸੀਂ ਆਪਣੀ ਜਿਹੜੀ ਗਲਤੀ ਹੈ ਉਸ ਨੂੰ ਜਾਂ ਤਾਂ ਥੋੜ੍ਹਾ ਸਮੇਂ ਸਿਰ ਆਪਣੀ ਸਪੀਡ ਜਿਹੜੀ ਡਿਲੀਵਰੀ ਦੀ ਉਸ ਨੂੰ ਵਧਾਉ ਜਿਹੜੇ ਤੁਹਾਡੇ ਡਿਲੀਵਰੀ ਵਾਲੇ ਕਰਮਚਾਰੀ ਨੇ ਉਹਨਾਂ ਨੂੰ ਤੁਸੀਂ ਹਦਾਇਤ ਕਰੋ ਵੀ ਉਹ ਸਮੇਂ ਸਿਰ ਡਿਲੀਵਰੀ ਪਹੁੰਚਾ ਦਿਆ ਕਰਨ ਕਿਉਂਕਿ ਸਾਨੂੰ ਬੜੀ ਪਰੇਸ਼ਾਨੀ ਜਿਹੜੀ ਹੈ ਉਹ ਉਸ ਦਾ ਸਾਹਮਣਾ ਕਰਨਾ ਪਿਆ ਨਹੀਂ ਤਾਂ ਫਿਰ ਤੁਸੀਂ ਮਤਲਬ ਆਪਣੇ ਜਿਹੜੇ ਡਿਲੀਵਰੀ ਕਰਮਚਾਰੀ ਨੇ ਉਹਨਾਂ ਨੂੰ ਬਦਲ ਸਕਦੇ ਹੋ